ਮੈਨੂੰ ਡਰਾਇੰਗ ਕਰਨਾ ਬਹੁਤ ਪਸੰਦ ਹੈ ਡਰਾਇੰਗ ਬਣਾਉਣ ਦਾ ਮੈਨੂੰ ਬਚਪਨ ਤੋਂ ਹੀ ਸ਼ੌਕ ਹੈ ਮੈਂ ਡਰਾਇੰਗ ਬਹੁਤ ਸੋਹਣੀ ਬਣਾਉਂਦਾ ਹਾਂ ਮੇਰਾ ਦੋਸਤ ਡਰਾਇੰਗ ਬਣਾ ਰਿਹਾ ਸੀ ਉਸਨੂੰ ਦੇਖ ਕੇ ਮੇਰੇ ਮਨ ਵਿੱਚ ਡਰਾਇੰਗ ਬਣਾਉਣ ਦੀ ਦਿਲਚਸਪੀ ਹੋਈ ਡਰਾਇੰਗ ਚਿੱਤਰਕਾਰੀ ਦੀ ਇੱਕ ਹੱਡੀ ਹੈ ਡਰਾਇੰਗ ਨੂੰ ਚਿੱਤਰਕਾਰੀ ਵਿੱਚ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ ਮੈਨੂੰ ਕੁਦਰਤੀ ਚੀਜ਼ਾਂ ਦੀ ਡਰਾਇੰਗ ਕਰਨਾ ਬਹੁਤ ਹੀ ਪਸੰਦ ਹੈ ਡਰਾਇੰਗ ਅਤੇ ਚਿੱਤਰਕਲਾ ਦਾ ਵਿਸ਼ਾ ਬੱਚਿਆਂ ਦੇ ਸਰਬਪੱਖੀ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹੈ ਡਰਾਇੰਗ ਕਾਰਨ ਬੱਚਾ ਆਲੇ ਦੁਆਲੇ ਕੁਦਰਤ ਨਾਲ ਅਤੇ ਆਪਣੇ ਆਪ ਨਾਲ ਜੁੜਿਆ ਰਹਿੰਦਾ ਹੈ